ਜੇਕਰ ਆਪਾਂ ਗੱਲ ਕਰੀਏ ਖੇਤੀਬਾੜੀ ਦੇ ਲਈ ਪਾਣੀ ਦੇ ਸਰੋਤਾਂ ਦੀ ਤਾਂ ਦੇਖਦੇ ਹਾਂ ਆਪਣੇ ਪੰਜਾਬ ਦੇ ਵਿੱਚ ਨਹਿਰਾਂ ਨੇ ਟਿਊਬਵੈੱਲ ਨੇ ਕਈ ਥਾਵਾਂ 'ਤੇ ਖੂਹਾਂ ਰਾਹੀਂ ਵੀ ਸਿੰਜਾਈ ਹੁੰਦੀ ਹੈ ਤੋ ਮੁੱਖ ਸਾਧਨਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਿੱਦਾਂ ਨਹਿਰ ਨਹਿਰਾਂ ਹੀ ਨੇ ਪਰ ਟਿਊਬਵੈੱਲਾਂ ਰਾਹੀਂ ਜੋ ਅੱਜ ਕੱਲ੍ਹ ਜ਼ਿਆਦਾ ਖੇਤੀ ਹੋ ਰਹੀ ਹੈ ਬਿਜਲੀ ਮੋਟਰਾਂ ਆਈਆਂ ਨੇ ਉਹਨਾਂ ਨੇ ਸੁਖਾਲਾ ਕਰ ਦਿੱਤਾ ਹੋਰ ਵੀ ਬਹੁਤ ਸਾਧਨ ਨੇ ਵੱਖ ਵੱਖ ਲੋਕਾਂ ਦੇ ਵਿੱਚ ਜਿੱਦਾਂ ਕਿ ਉੱਚੀਆਂ ਜੋ ਜ਼ਮੀਨਾਂ ਉੱਚੀਆਂ ਨੇ ਜਿੱਥੇ ਪਾਣੀ ਦਾ ਲੈਵਲ ਨਹੀਂ ਹੈ ਉੱਥੇ ਬਰਮੇ ਦੁਆਰਾ ਪਾਣੀ ਚੜ੍ਹਾਇਆ ਜਾਂਦਾ ਗਾ ਪਰ ਮੁੱਖ ਸਰੋਤ ਦੀ ਗੱਲ ਕਰੀਏ ਤਾਂ ਨਹਿਰਾਂ ਹੀ ਨੇ ਪਾਣ ਜ਼ਮੀਨ ਨੂੰ ਸਿੰਜਿਆ ਜਾ ਰਿਹਾ ਜ਼ਮੀਨ ਦੀ ਸਿੰਚਾਈ ਹੋ ਰਹੀ ਹੈ ਪਾਣੀ ਨਾਲ ਕਿਉਂਕਿ ਪਾਣੀ ਤੋਂ ਬਿਨਾਂ ਜ਼ਮੀਨ ਦਾ ਕੋਈ ਅਰਥ ਨਹੀਂ ਜਿਵੇਂ ਆਤਮਾ ਤੋਂ ਬਿਨਾਂ ਸਰੀਰ ਦਾ ਕੋਈ ਅਰਥ ਨਹੀਂ ਉਸੇ ਤਰਾਂ ਪਾਣੀ ਤੋਂ ਬਿਨਾਂ ਜ਼ਮੀਨ ਦਾ ਵੀ ਕੋਈ ਅਰਥ ਨਹੀਂ ਹੈ ਖੇਤੀਬਾੜੀ ਪੰਜਾਬ ਦਾ ਪ੍ਰਧਾਨ ਕਿੱਤਾ ਰਿਹਾ ਪੁਰਾਣੇ ਸਮਿਆਂ ਤੋਂ ਤਾਂ ਹੋ ਸਕਦਾ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਵੀ ਖੇਤੀਬਾੜੀ ਆ ਜੋ ਪ੍ਰਧਾਨ ਕਿੱਤਾ ਰਹੇ ਪਰ ਖੇਤੀਬਾੜੀ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਇਹਨੂੰ ਸਹੀ ਸਮੇਂ 'ਤੇ ਲੋੜ ਅਨੁਸਾਰ ਪਾਣੀ ਦੀ ਮਾਤਰਾ ਉਪਲਬਧ ਹੋਵੇ ਸੋ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਖੇਤਾਂ ਤੱਕ ਬੰਨ੍ਹ ਤੱਕ ਪਾਣੀ ਪਹੁੰਚਾਉਣ ਦੇ ਲਈ ਪਾਇਪਲਾਈਨਾਂ ਨੇ ਪਲਾਸਟਿਕ ਦੀਆਂ ਪਾਇਪਲਾਈਨਾਂ ਨੇ ਸਮਿੰਟਡ ਜੋ ਸੀਮੈਂਟ ਦੀਆਂ ਬਣੀਆਂ ਹੋਈਆਂ ਪਾਈਪਾਂ ਨੇ ਉਹ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਨੇ ਸੋ ਇਸੇ ਤਰ੍ਹਾਂ ਹਰ ਇੱਕ ਖੇਤ ਤੱਕ ਪਾਣੀ ਪਹੁੰਚਾਉਣ ਲਈ ਸਰਕਾਰ ਯਤਨ ਕਰ ਰਹੀ ਹੈ